ਇੱਕ ਬਾਈਕਰ ਵਜੋਂ ਮੈਨੂੰ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਖ਼ਰਾਬ ਟਰੈਫਿਕ ਵਿੱਚ ਹੌਲੀ ਜਾਣਾ ਚਾਹੀਦਾ ਹੈ ਅਤੇ ਤੇਜੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਦੂਜਿਆਂ ਦਾ ਅਤੇ ਮੇਰਾ ਕੋਈ ਨੁਕਸਾਨ ਨਾ ਹੋਵੇ ਅਤੇ ਤੰਗ ਸੜਕਾਂ ਵਿੱਚ ਵੀ ਸਾਨੂੰ ਹੌਲੀ ਜਾਣਾ ਚਾਹੀਦਾ ਹੈ ਅਤੇ ਓਵਰਟੇਕ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਾ ਅਸ ਸਾਨੂੰ ਸੱਟ ਨਾ ਲੱਗੇ ਅਤੇ ਖ਼ਰਾਬ ਮੌਸਮ ਵਿੱਚ ਵੀ ਸਾਨੂੰ ਰੁਕ ਜਾਣਾ ਚਾਹੀਦਾ ਹੈ ਕਿਉਂਕਿ ਖ ਖੱਡੇ ਅਤੇ ਨਾਲੀਆਂ ਆਦਿ ਵਿੱਚ ਅਸੀਂ ਡਿੱਗ ਸਕਦੇ ਹਾਂ ਅਤੇ ਸਾਨੂੰ ਸੱਟ ਲੱਗ ਸਕਦੀ ਹੈ ਅਤੇ ਰਾਹ ਵਿੱਚ ਜਾਂਦੇ ਸਾਨੂੰ ਹੌਲੀ ਚੱਲਣਾ ਚਾਹੀਦਾ ਹੈ ਕਿਉਂਕਿ ਜਾਨਵਰਾਂ ਦਾ ਅੱਗੇ ਆ ਸਕਦੇ ਹਨ ਜਿਸ ਨਾਲ ਸਾਨੂੰ ਅਤੇ ਜਾਨਵਰ ਨੂੰ ਸੱਟ ਲੱਗ ਸਕਦੀ ਹੈ ਅਤੇ ਇਸ ਵਿੱਚ ਸਾਡੀ ਜਾਨ ਵੀ ਜਾ ਸਕਦੀ ਹੈ